ਸਤਿ ਸ਼੍ਰੀ ਅਕਾਲ ਸ਼ਿਵਾਨੀ ਵਧੀਆ ਤੁਸੀਂ ਦੱਸੋ ਕੀ ਕਰਦੇ ਸੀ ਅੱਛਾ ਚਲੋ ਵਧੀਆ ਘਰ ਦਾ ਕੰਮ ਹੋ ਗਿਆ ਇੰਨੀ ਜਲਦੀ ਹੋ ਗਿਆ ਅੱਛਾ ਓ ਠੰਡਾ ਵੀ ਬਹੁਤ ਹੋ ਗਿਆ ਧੁੰਦਾ ਵੀ ਪੈਣੀਆਂ ਸ਼ੁਰੂ ਹੋ ਗਿਆ ਠੰਡ ਹੀ ਬੜੀ ਵੱਧਗੀ ਹ ਪਾਣੀ ਚ ਹੱਥ ਨਹੀਂ ਪੈਂਦਾ ਗਰਮ ਪਾਣੀ ਭਾਂਡੇ ਵੀ ਗਰਮ ਪਾਣੀ ਨਾਲ ਹੀ ਧੁੱਪਦੇ ਆ

ਬਸ ਵਧੀਆ ਸਭ ਘਰ ਬਾਰ ਵਧੀਆ ਚੱਲੀ ਜਾਂਦਾ ਹੈਗਾ ਬਸ ਮੇਰੀ ਨਾ ਮੈਂ ਤੁਹਾਨੂੰ ਇੱਕ ਗੱਲ ਕਰਨੀ ਸੀ ਮੈਂ ਤੁਹਾਨੂੰ ਇਹ ਪੁੱਛਣਾ ਸੀ ਰਸਤਿਆਂ ਬਾਰੇ ਪਹਿਲਾਂ ਨਾ ਪਹਿਲਾਂ ਨਾ ਮੇਰੇ ਮਤਲਬ ਕਿ ਘਰ ਵਾਲਾ ਜਿਹੜਾ ਸੀ ਉਹ ਨਾ ਮਤਲਬ ਕਿ ਮਤਲਬ ਕਿ ਜਿਹੜੇ ਮੇਰੇ ਘਰ ਵਾਲੇ ਸੀ ਨਾ ਉਹ ਨਾ ਮੈਨੂੰ ਬਠਿੰਡੇ ਅਸੀਂ ਬਠਿੰਡੇ ਪਹਿਲਾਂ ਮੇਰੀ ਨੌਕਰੀ ਸੀ ਨਾ ਉਹ ਮੈਨੂੰ ਬੱਸ ਸਟੈਂਡ ਤਿਕਰ ਛੱਡ ਦਿੰਦੇ ਸੀ ਤੇ ਮੈਂ ਸਿੱਧਾ ਬਠਿੰਡੇ ਚਲੀ ਜਾਂਦੀ ਹੁੰਦੀ ਸੀ ਪਰ ਹੁਣ ਬਠਿੰਡ ਕੰਪਨੀਆਂ ਵਾਲਿਆਂ ਨੇ ਨਾ ਮੇਰੀ ਟਰਾਂਸਫਰ ਮਤਲਬ ਕਿ ਇੱਥੇ ਹੀ ਕਰਤਾ ਫਰੀਦਕੋਟ ਈ ਕਰਤਾ ਤੇ ਜਿਸ ਤੇ ਜਿਸ ਕਰਕੇ ਨਾ ਅਸੀਂ ਫਿਰ ਇੱਕ ਨਵੀਂ ਗੱਡੀ ਲੈ ਲਈ ਵੀ ਸੋਚ ਕੇ ਦੋਵਾਂ ਜਾਣਿਆਂ ਨੇ ਤੁਹਾਨੂੰ ਵੀ ਬਹੁਤ ਬਹੁਤ ਐਕਸ ਯੂ ਵੀ ਸੈਵਨ ਹੰਡਰਡ ਲੈ ਲਈ ਗੱਡੀ ਦੋਵਾਂ ਨੇ ਮਿਲ ਕੇ ਇਹ ਬੜੀ ਵਧੀਆ ਕਹਿੰਦੇ ਗੱਡੀ ਹੈਗੀ ਹ ਹੈ ਤਾਂ ਸੈਵਨ ਸੀਟਰ ਵੀ ਕਦੀ ਅਸੀਂ ਜਾਣਾ ਬਾਹਰ ਆਣਾ ਜਾਣਾ ਹੁੰਦਾ ਨਾ ਤੇ ਇਸ ਕਰਕੇ ਵਧੀਆ ਰਹਿੰਦੀ ਹ ਸਾਨੂੰ ਗੱਡੀ ਤੇ ਹੋਰ ਕੀ ਮੈਮ ਤੇ ਮੈਂ ਤੁਹਾਨੂੰ ਇਹ ਕਹਿਣ ਲੱਗੀ ਸੀ ਵੀ ਨਾ ਦੇਖੋ ਕੀ ਨਾਮ ਅਸੀਂ ਜਾਣਾ ਹੁੰਦਾ ਹੁਣ ਮੈਂ ਆਪਦੀ ਮੈਂ ਨਾ ਜਦੋਂ ਦਾ ਮੇਰਾ ਵਿਆਹੀ ਆਈ ਆ ਨਾ ਮੈਂ ਫਰੀਦਕੋਟ ਵਿੱਚ ਇਹਨਾਂ ਬਾਹਰ ਨਹੀਂ ਨਿਕਲੀ ਤੇ ਮੈਨੂੰ ਨਾ ਇਹਨਾਂ ਦੇ ਰਸਤਿਆਂ ਬਾਰੇ ਨਹੀਂ ਪਤਾ ਹੈਗਾ ਔਰ ਤੇ ਫਿਰ ਇੱਕ ਵਾਰੀ ਨਾ ਮੈਂ ਕੰਪਨੀ ਚੱਲੀ ਤੇ ਮੈਂ ਇੱਕ ਵਾਰੀ ਹੁਣ ਮੈਂ ਗੱਡੀ ਲੈ ਕੇ ਹੁਣ ਮੈਂ ਬਾਜ਼ਾਰ 'ਚ ਤਾਂ ਫਸਾ ਨਹੀਂ ਸਕਦੀ ਤੁਹਾਨੂੰ ਪਤਾ ਹੀ ਹ ਤੇ ਸਵੇਰੇ ਕਿੰਨਾ ਰੱਸ਼ ਹੁੰਦਾ ਜਦੋਂ ਬੱਚਿਆਂ ਨੂੰ ਛੁੱਟੀ ਹੁੰਦੀ ਹ

ਹੋਰ ਕੀ ਮੈਂ ਤਾਂ ਇੱਕ ਦਿਨ ਗੱਡੀ ਫਸਾ ਲਈ ਬਾਜ਼ਾਰ ਦੇ ਵਿੱਚ ਗਲਤੀ ਕਰ ਲਈ ਭੈਣੇ ਗੱਡੀ ਫਸਾਲੀ ਮੈਂ ਬਾਜ਼ਾਰ ਦੇ ਵਿੱਚ ਗਲਤੀ ਹੋ ਗਈ ਮੇਰੇ ਤੋਂ ਤੇ ਮੇਰੀ ਤਾਂ ਇੱਕ ਤਾਂ ਬੰਦੇ ਨਾਲ ਲੜਾਈ ਹੋ ਗਈ ਉਹ ਕਹਿੰਦਾ ਗੱਡੀ ਕੱਢ ਲਾ ਇਨਾ ਜਾਮ ਹ ਕੀ ਕਹਿੰਦਾ ਉੱਥੇ ਲਗਾ ਤਾ ਤੇ ਮਸਾਂ ਹੀ ਗੱਡੀ ਔਖੇ ਸੌਖੇ ਹੋ ਕੇ ਗੱਡੀ ਫਿਰ ਉਸ ਤੋਂ ਬਾਅਦ ਤਾਂ ਮੈਂ ਇਹ ਕਹਿ ਤਾ ਕਦੀ ਬਾਜ਼ਾਰ ਚੋਂ ਨਹੀਂ ਕੱਢਣੀ ਗੱਡੀ ਮੈਨੂੰ ਤਾਂ ਰਸਤਿਆਂ ਬਾਰੇ ਪਤਾ ਨਹੀਂ ਤੇ ਮੈਂ ਤਾਂ ਗੱਡੀ ਫਸਾ ਕੇ ਬੈਠ ਗਈ ਗਲਤੀ ਨਾਲ ਉਥੇ ਤੁਸੀਂ ਮੈਨੂੰ ਇਥੇ ਦੱਸ ਸਕਦੇ ਹੋ ਵੀ ਕਿਵੇਂ ਕੋਈ ਰਸਤਾ ਕੋਈ ਸੌਖਾ ਜਿਹਾ ਹੋਵੇ ਹਾਂਜੀ ਮੈਂ ਕੀ ਨਾਮ ਹੈ ਬਾਜੀਗਰ ਬਸਤੀ ਤੋਂ ਆਉਂਦੀ ਆਂ ਹਾਂਜੀ ਤੇ ਇਥੋਂ ਕੋਈ ਰਸਤਾ ਸਕਦੇ ਹੋ ਅੱਛਾ ਅੱਛਾ ਅੱਛਾ ਚਲੋ ਵਧੀਆ ਫਿਰ ਮੈਂ ਇਦਾਂ ਕਰੂੰਗੀ ਮੈਂ ਇਹਨਾਂ ਨੂੰ ਕਹੂੰਗੀ ਵੀ ਇੱਕ ਵਾਰੀ ਮੈਨੂੰ ਲੈ ਜਾਣਾ ਉਸ ਰਸਤੇ ਤੋਂ ਤੇ ਫਿਰ ਮੈਂ ਰਾਸਤਾ ਸਿੱਖ ਲੂਗੀ ਵੀ ਜੇ ਖਾਲੀ ਸੜਕ ਹੁੰਦੀ ਹ ਤੇ ਫਿਰ ਮੈਂ ਉਥੋਂ ਹੀ ਜਾ ਵੜਿਆ ਕਰੂੰਗੀ ਨਹੀਂ ਤਾਂ ਹੋਰ ਕੀ ਹਾਂਜੀ ਉਹੀ ਤਾਂ ਮੈਨੂੰ ਬਸ ਮੈਨੂੰ ਤਾਂ ਐਕਸੀਡੈਂਟਾਂ ਤੋਂ ਵੀ ਬੜਾ ਡਰ ਲੱਗਦਾ ਅੱਜ ਕੱਲ ਆਏ ਦਿਨ ਐਕਸੀਡੈਂਟ ਹੋਣ ਲੱਗ ਜਾਂਦੇ ਹੈਗੇ ਆ ਮੇਨੂੰ ਡਰ ਲੱਗਦਾ ਕਿਤੇ ਮੇਰੀ ਗੱਡੀ ਨਾ ਠੁੱਕ ਜੇ ਕਿਸੇ ਚ ਹਾਂਜੀ ਪਰ ਫਿਰ ਵੀ ਦੇਖੋ ਸ਼ਿਵਾਨੀ ਵੀ ਡਰ ਤਾਂ ਲੱਗਦਾ ਹੀ ਤੁਹਾਨੂੰ ਪਤਾ ਹੀ ਹੈ ਵੀ ਐਕਸੀਡੈਂਟ ਆਏ ਦਿਨ ਨਵੀਂ ਖਬਰ ਹੁੰਦੀ ਹੈ ਤੁਹਾਨੂੰ ਪਤਾ ਟ੍ਰੈਫਿਕ ਦੇ ਵਿੱਚੋਂ ਗੱਡੀ ਕੱਢਣੀ ਸੌਖੀ ਗੱਲ ਹ ਤੇ ਇੱਕ ਹੈ ਵੀ ਸੈਵਨ ਸੀਟਰ ਨੂੰ ਤਾਂ ਕੱਢਣਾ ਹੀ ਬੜਾ ਔਖਾ ਗੱਲ ਹ ਚਲੋ ਬਸ ਤੁਸੀਂ ਦੱਸਤਾ ਤੁਹਾਡਾ ਥੈਂਕਯੂ ਵੀ ਧੰਨਵਾਦ ਬਹੁਤ ਬਹੁਤ ਮੈਂ ਹੁਣ ਮੈਂ ਉਹਨਾਂ ਨੂੰ ਕਹੂੰਗੀ ਵੀ ਇਸ ਰਸਤੇ ਚੋ ਹੀ ਲੈ ਜਿਆ ਕਰਨ ਚਲੋ ਹਾਂਜੀ ਥੈਂਕਯੂ ਧੰਨਵਾਦ